ਸਾਡੇ ਭਾਈਚਾਰੇ ਵਿੱਚ ਪ੍ਰਸਿੱਧ ਭਾਈਚਾਰਕ ਸਮਾਗਮ ਬਹੁਤ ਹਨ ਜਿੱਥੇ ਬਹੁਤ ਸਾਰੇ ਲੋਕ ਪਾਰਟੀ ਲਈ ਇਕੱਠੇ ਹੁੰਦੇ ਹਨ ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਕਿ ਮੇਲੇ ਅਤੇ ਤਿਉਹਾਰ ਜੋ ਕਿ ਸਾਡੇ ਬਹੁਤ ਭਾਈਚਾਰਕ ਸਮਾਗਮ ਹਨ ਮੈਂ ਤੁਹਾਨੂੰ ਆਪਣੇ ਪਿੰਡ ਤੋਂ ਚਾਰ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਪਿੰਡ ਦੀ ਗੱਲ ਦੱਸਦਾ ਹਾਂ ਜਿੱਥੇ ਕਿ ਇੱਕ ਪਿੰਡ ਦਾ ਨਾਮ ਬੁਰਜ ਹੈ ਅਤੇ ਉੱਥੇ ਛਿੰਜ ਦਾ ਮੇਲਾ ਭਰਦਾ ਹੈ ਜਿੱਥੇ ਕਿ ਲੋਕ ਬਹੁਤ ਦੂਰੋਂ ਦੂਰੋਂ ਇਕੱਠੇ ਹੁੰਦੇ ਹਨ ਇਸ ਮੇਲੇ ਇਹ ਮੇਲਾ ਗੁੱਗੇ ਮਾੜੀ 'ਤੇ ਲੱਗਦਾ ਹੈ ਜਿੱਥੇ ਕਿ ਕੁਸ਼ਤੀਆਂ ਵੀ ਕਰਾਈਆਂ ਜਾਂਦੀਆਂ ਹਨ ਅਜਿਹੇ ਬਹੁਤ ਸਾਰੇ ਸਮਾਗਮ ਹਨ ਜਿਵੇਂ ਕਿ ਵਿਆਹ ਪਾਰਟੀਆਂ ਜਨਮਦਿਨ ਜਿੱਥੇ ਲੋਕ ਇਕੱਠੇ ਹੁੰਦੇ ਹਨ ਅਤੇ ਮਸਤੀਆਂ ਕਰਦੇ ਹਨ ਅਤੇ ਹੋਰ ਵੀ ਕਹਿ ਸਕਦੇ ਹਾਂ ਰਿੰਗ ਸੈਰੇਮਨੀ ਵਗੈਰਾ ਵੀ ਜਾਂ ਫਿਰ ਕੋਈ ਖੁਸ਼ੀ ਦਾ ਪਾਠ ਅਜਿਹੇ ਬਹੁਤ ਸਾਰੇ ਹੋਰ ਹਨ ਜਿਵੇਂ ਕਿ ਸਾਡੇ ਪਿੰਡ ਤੋਂ ਫਤਿਹਗੜ੍ਹ ਸਾਹਿਬ ਹੈ ਜਿੱਥੇ ਕਿ ਇਸ ਤੋਂ ਅੱਗੇ ਆਮ ਖਾਸ ਬਾਗ ਹੈ ਉੱਥੇ ਹਰ ਸਾ ਹਰ ਸਾਲ ਮੰਡੀ ਵਿੱਚ ਇੱਕ ਮੇਲਾ ਲੱਗਦਾ ਹੈ